ਮੈਂ ਪਟਿਆਲੇ ਦੀ ਵਸਨੀਕ ਹਾਂ ਜਿਹਦੇ ਵਿੱਚ ਜੇ ਮੈਂ ਸਿੱਖਿਆ ਦੇ ਵਿੱਚ ਦੱਸਾਂ ਤਾਂ ਔਰਤਾਂ ਨੂੰ ਜਿਹੜੀ ਹੈਗੀ ਹੈ ਸਿੱਖਿਆ ਦੇ ਵਿੱਚ ਮੌਕੇ ਤਾਂ ਬਰਾਬਰ ਦੇ ਹੈਗੇ ਨੇ ਸਾਰਿਆਂ ਲਈ ਪਰ ਇੱਥੇ ਸਿੱਖਿਆ ਜਿਹੜੀ ਉਹ ਬਹੁਤ ਮਹਿੰਗੀ ਹੈ ਕਿਉਂਕਿ ਇੱਥੇ ਜਿਹੜੀ ਨਿੱਜੀ ਸੰਸਥਾਵਾਂ ਜ਼ਿਆਦਾ ਨੇ ਸਰਕਾਰੀ ਸੰਸਥਾਵਾਂ ਘੱਟ ਨੇ ਜਿਨ੍ਹਾਂ ਨਾਲ ਜਿਹੜੀ ਔਰਤਾਂ ਸਿੱਖਿਆ ਘੱਟ ਪ੍ਰਾਪਤ ਕਰ ਸਕਦੀਆਂ ਨੇ ਕਿਉਂਕਿ ਸਿੱਖਿਆ ਜਿਹੜੀ ਮਹਿੰਗੀ ਹੋਣ ਕਾਰਨ ਰੁਜ਼ਗਾਰ ਦੇ ਵਿੱਚ ਵੀ ਜਿਹੜੇ ਹੈਗੇ ਆ ਔਰਤਾਂ ਨੂੰ ਫਿਰ ਰੁਜ਼ਗਾਰ ਵੀ ਜਿਹੜੇ ਉਹਦੇ ਮੌਕੇ ਘੱਟ ਮਿਲਦੇ ਨੇ ਕਿਉਂਕਿ ਪਹਿਲਾਂ ਤਾਂ ਉਹਨਾਂ ਨੂੰ ਸਿੱਖਿਆ ਜਿਹੜੀ ਹੈਗੀ ਹੈ ਉਹਦੇ ਵਿੱਚ ਮੌਕਾ ਨਹੀਂ ਮਿਲਦਾ ਤਾਂ ਕਰਕੇ ਉਹ ਰੁਜ਼ਗਾਰ ਵੀ ਨਹੀਂ ਪ੍ਰਾਪਤ ਕਰ ਸਕਦੀਆਂ ਅਤੇ ਜਿੱਥੇ ਵੀ ਜਾਂਦੀਆਂ ਉਹਨਾਂ ਨੂੰ ਤਨਖਾਹ ਜਿਹੜੀ ਘੱਟ ਦਿੱਤੀ ਜਾਂਦੀ ਹੈ ਜੇ ਸਮਾਜਿਕ ਸਥਿਤੀ ਦੇ ਰੂਪ ਦੇ ਵਿੱਚ ਦੇਖੀਏ ਤਾਂ ਆਪਣੇ ਅੱਜ ਦੀ ਇੱਕੀਵੀਂ ਸਦੀ ਦੇ ਵਿੱਚ ਪੜ੍ਹਿਆ ਲਿਖਿਆ ਸਮਾਜ ਹੋਣ ਦੇ ਬਾਵਜੂਦ ਵੀ ਜਿਹੜੀ ਔਰਤ ਹੈ ਉਹ ਰਾਤ ਨੂੰ ਕਿਤੇ ਇਕੱਲੀ ਜਿਹੜੀ ਨਹੀਂ ਜਾ ਸਕਦੀ ਹੈਗੀ ਉਹਨੂੰ ਖਤਰਾ ਬਣਿਆ ਰਹਿੰਦਾ ਆ ਇਹ ਜੋ ਕਿ ਇਹ ਸਭ ਤੋਂ ਵੱਡੀ ਜਿਹੜੀ ਵੰਗਾਰ ਹੈਗੀ ਆ ਉਹਨਾਂ ਦੇ ਸਾਹਮਣੇ ਹੈਗੀ ਆ